ਹਾਂਜੀ ਜੇ ਗੱਲ ਕਰੀਏ ਆਪਾਂ ਸੱਭਿਆਚਾਰਕ ਤਿਉਹਾਰਾਂ ਅਤੇ ਸਮਾਗਮਾਂ ਦੀ ਅਸੀਂ ਲਗਭਗ ਪੰਜਾਬ ਸਾਡੇ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਸਾਰੇ ਜਿਹੜੇ ਤਿਉਹਾਰ ਨੇ ਲੋਹੜੀ ਵਿਸਾਖੀ ਅਸੀਂ ਬਹੁਤ ਧੂਮ ਧਾਮ ਨਾਲ ਮਨਾਉਂਦੇ ਹਨ ਜਿਹੜਾ ਹੈਗਾ ਲੋਹੜੀ ਲੋਹੜੀ ਦਾ ਤਿਉਹਾਰ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਿਸੇ ਦੇ ਘਰ ਕੋਈ ਕਿਸੇ ਲੜਕੇ ਦਾ ਜਨਮ ਹੁੰਦਾ ਸੀਗਾ ਉਸ ਟਾਈਮ ਲੋਹੜੀ ਧੂਮ ਧਾਮ ਨਾਲ ਮਨਾਈ ਜਾਂਦੀ ਸੀਗੀ ਪਰ ਅਜੋਕਾ ਸਮਾਂ ਜੋ ਹੈ ਉਹ ਬਹੁਤ ਬਦਲ ਚੁੱਕਾ ਹੈ ਉਸ ਲਈ ਮੁੰਡੇ ਜਾਂ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ ਹੈ ਉਹ ਕੁੜੀ ਦੀ ਵੀ ਲੋਹੜੀ ਉਵੇਂ ਹੀ ਸ਼ਾਨ ਨਾਲ ਮਨਾਉਂਦੇ ਹਨ ਜਿਵੇਂ ਕਿ ਮੁੰਡੇ ਦੀ ਮਨਾਉਂਦੇ ਹਾਂ ਜੇ ਗੱਲ ਕਰੀਏ ਹੁਣ ਤਿਉਹਾਰ ਦੀ ਅਤੇ ਹੋਲੀ ਦੀ ਹੋਲੀ ਦਾ ਤਿਉਹਾਰ ਵੀ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਹੋਲੀ ਦੇ ਤਿਉਹਾਰ ਦਾ ਕੀ ਮਹੱਤਤਾ ਹੈ ਇਸ ਦਿਨ ਲੋਕ ਇੱਕ ਦੂਜੇ ਨੂੰ ਰੰਗ ਗੁਲਾਲ ਲ ਲਾਉਂਦੇ ਹਨ ਜੋ ਕਿ ਬਹੁਤ ਹੀ ਵਧੀਆ ਤਿਉਹਾਰ ਮੰਨਿਆ ਜਾਂਦਾ ਇਸ ਦਿਨ ਬੱਚੇ ਆਪ ਆਪਣਾ ਫੁਲਚੜੀਆਂ ਜਾਂ ਜਿਹੜੀਆਂ ਦੂਸਰੀਆਂ ਪਿਚਕਾਰੀਆਂ ਹੁੰਦੀਆਂ ਹਨ ਉਹਨਾਂ ਦੀ ਵਰਤੋਂ ਕਰਦੇ ਹਨ ਇੱਕ ਦੂਜੇ ਪਰ ਰੰਗ ਪਾਉਂਦੇ ਹਨ ਜੋ ਕਿ ਬਹੁਤ ਵਧੀਆ ਲੱਗਦਾ ਹੈ ਦੇਖਣ ਨੂੰ ਵੀ ਵਧੀਆ ਲੱਗਦਾ ਹੈ ਛੋਟੇ ਬੱਚੇ ਇਸ ਦਿਨ ਰੰਗੋਲੀ ਬਣਾਉਂਦੇ ਹਨ ਜੋ ਕਿ ਘਰਾਂ ਦੇ ਵਿੱਚ ਜਦੋਂ ਮੇਨ ਗੇਟ ਦੇ ਅੰਦਰ ਵੜਨਾ ਹੁੰਦਾ ਹੈ ਉਸ ਦਿਨ ਛੋਟੇ ਬੱਚੇ ਉਹ ਅੱਗੇ ਮੇਨ ਗੇਟ 'ਤੇ ਰੰਗੋਲੀ ਬਣਾਉਂਦੇ ਹਨ ਔਰ ਬੱਚਿਆਂ ਦਾ ਕਿ ਫਿਰ ਬੱਚੇ ਜਦੋਂ ਘਰ ਦੇ ਅੰਦਰ ਵੜਨਾ ਹੁੰਦਾ ਹੈ ਤਾਂ ਪਰਿਵਾਰ ਦੇ ਜਿਹੜੇ ਵੱਡੇ ਮੈਂਬਰਾਂ ਨੂੰ ਉਹਨਾਂ ਨੂੰ ਘੂਰਦੇ ਹਨ ਵੀ ਸਾਡੀ ਰੰਗੋਲੀ ਕਿਤੇ ਖਰਾਬ ਨਾ ਕਰ ਦਿਓ ਸਾਡੀ ਰੰਗੋਲੀ ਕਿਤੇ ਖਰਾਬ ਨਾ ਕਰ ਦਿਓ